ਟੈਕਨੋਲਜੀ ਅਤੇ ਇੰਟਰਨੈਟ ਦੇ ਵਧਣ ਨਾਲ ਪੰਜਾਬੀ ਭਾਸ਼ਾ ਦੀ ਵਰਤੋਂ ਕਿਵੇਂ ਬਦਲ ਗਈ ਹੈ ਪੰਜਾਬੀ ਭਾਸ਼ਾ ਦੀ ਵਰਤੋਂ ਟੈਕਨੋਲਜੀ ਅਤੇ ਇੰਟਰਨੈਟ ਕਰਕੇ ਇਸ ਲਈ ਹੀ ਘੱਟ ਗਈ ਹੈ ਕਿਉਂਕਿ ਇਹ 'ਤੇ ਬਹੁਤ ਪ੍ਰਭਾਵ ਪਿਆ ਹੈ ਕਿਉਂਕਿ ਜਿਤਨੇ ਵੀ ਸੋਸ਼ਲ ਮੀਡੀਆ 'ਤੇ ਐਪਸ ਨੇ ਇੰਸਟਾਗਰਾਮ ਫੇਸਬੁੱਕ ਸਨੈਪਚੈਟ ਟਵੀਟਰ ਉਹ ਸਭ ਵਿੱਚ ਇੰਗਲਿਸ਼ ਅੰਗਰੇਜ਼ੀ ਭਾਸ਼ਾ ਦਾ ਹੀ ਵਰਤੋਂ ਕੀਤੀ ਜਾਂਦੀ ਹੈ ਪੰਜਾਬੀ ਭਾਸ਼ਾ ਨੂੰ ਦੂਰ ਦੂਰ ਤੱਕ ਪੁੱਛਿਆ ਨਹੀਂ ਜਾਂਦਾ ਉਹ 'ਚ ਅਤੇ ਇਸ 'ਤੇ ਜ਼ਿਆਦਾਤਰ ਪੰਜਾਬੀ ਭਾਸ਼ਾ ਦੀ ਵਰਤੋਂ ਇਸ ਕਰਕੇ ਵੀ ਘੱਟ ਗਈ ਹੈ ਕਿਉਂਕਿ ਵੈਸਟਰਨ ਸਾਈਟ ਦਾ ਬਹੁਤ ਬਹੁਤ ਜ਼ਿਆਦਾ ਪ੍ਰਭਾਵ ਪਿਆ ਹੈ ਲੋਕਾਂ 'ਤੇ ਲੋਕ ਪੰਜਾਬੀ ਪਹਿਰਾਵੇ ਨੂੰ ਛੱਡ ਕੇ ਦੂਜਾ ਪਹਿਰਾਵਾ ਅਪਨਾਉਣ ਲੱਗ ਪਏ ਨੇ ਅਤੇ ਭਾਸ਼ਾ 'ਚ ਬਹੁਤ ਦੂਰ ਦੀ ਗੱਲ ਹੈ ਜਦੋਂ ਬੰਦਾ ਆਪਣਾ ਪਹਿਰਾਵਾ ਵਗੈਰਾ ਹੀ ਸਭ ਭੁੱਲ ਜਾਵੇ ਨਵੇਂ ਲੋਕਾਂ ਨੂੰ ਵੇਖ ਕੇ ਨਾਲੇ ਜਿੰਨੀ ਵੀ ਹੁਣ ਅੱਜ ਕੱਲ ਨੌਕਰੀਆਂ ਨੇ ਉਹ ਸਭ ਵਿੱਚ ਅੰਗਰੇਜ਼ੀ ਜਾਂ ਹਿੰਦੀ ਦੀ ਹੀ ਵਰਤੋਂ ਜ਼ਿਆਦਾਤਰ ਕੀਤੀ ਜਾਂਦੀ ਹੈ ਜਿੰਨੀ ਵੀ ਕੰਪਨੀਆਂ ਵਾਲੀਆਂ ਨੇ ਇੰਟਰਨੈਟ ਕੰਪਨੀਆਂ ਨੇ ਸਭ ਇਹੀ ਚਾਹੁੰਦੇ ਨੇ ਕਿ ਉਹ ਬੱਚਿਆਂ ਨੂੰ ਅੰਗਰੇਜ਼ੀ ਹੀ ਆਵੇ ਅੰਗਰੇਜ਼ੀ ਦੇ ਸਿਵਾ ਕੁਛ ਨਾ ਆਵੇ ਟੈਸਟ ਦਾ ਵੀ ਬਹੁਤ ਜ਼ਿਆਦਾ ਪ੍ਰਭਾਵ ਪਿਆ ਹੈ ਪਰ ਸਰਕਾਰ ਨੇ ਇੱਕ ਬਹੁਤ ਵਧੀਆ ਕੰਮ ਕੀਤਾ ਹੈ ਉਹਨਾਂ ਨੇ ਕਿਹਾ ਹੈ ਕਿ ਜੇ ਤੁਹਾਨੂੰ ਸਰਕਾਰੀ ਨੌਕਰੀ ਚਾਹੀਦੀ ਹੈ ਤਾਂ ਤੁਹਾਨੂੰ ਪੰਜਾਬੀ ਆਉਣੀ ਚਾਹੀਦੀ ਹੈ ਸਾਨੂੰ ਵੀ ਇੱਦਾਂ ਹੈ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਹੋਰ ਇੱਦਾਂ ਦੇ ਦੋ ਚਾਰ ਨਿਯਮ ਕੱਢਣ ਤਾਂ ਜੋ ਪੰਜਾਬੀ ਭਾਸ਼ਾ ਟਿਕੀ ਰਹਿ ਸਕੇ ਪਰ ਸਭ ਤੋਂ ਵੱਧ ਪ੍ਰਭਾਵ ਇੱਕ ਇਹ ਵੀ ਪਿਆ ਹੈ ਇੰਟਰਨੈਟ ਦੇ ਇਲਾਵਾ ਕਿ ਬਾਰ੍ਹਵੀਂ ਜਮਾਤ ਤੋਂ ਬਾਅਦ ਪੰਜਾਬੀ ਜੇ ਕਿਤੇ ਸਿਖਾਈ ਹੀ ਨਹੀਂ ਜਾਂਦੀ ਜਿੰਨੀ ਪੰਜਾਬੀ ਸਿਖਾਈ ਜਾਂਦੀ ਹੈ ਸਭ ਬਾਰ੍ਹਵੀਂ ਤੱਕ ਜਾਂ ਦਸਵੀਂ ਤੱਕ ਹੀ ਸਿਖਾਈ ਜਾਂਦੀ ਹੈ ਅਤੇ ਇੰਟਰਨੈਟ ਅਤੇ ਸੋਸ਼ਲ ਮੀਡੀਆ ਨੇ ਤਾਂ ਇਹ ਪੰਜਾਬੀ ਨੂੰ ਇੱਕਦਮ ਹੀ ਗਾਇਬ ਹੀ ਕਰ ਛੱਡਿਆ ਹੈ ਹੁਣ ਤਾਂ ਪਿੰਡਾਂ ਦੇ ਵੀ ਬੱਚੇ ਜਿਹੜੇ ਪੈਦਾ ਹੀ ਹੁੰਦੇ ਨੇ ਉਹ ਵੀ ਸਿੱਧਾ ਅੰਗਰੇਜ਼ੀ ਬੋਲਣ ਲੱਗ ਪੈਂਦੇ ਨੇ